ਪੰਜਾਬ ਦੇ ਲੋਕ ਖਾਣ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਨੇ ਅਤੇ ਮੈਨੂੰ ਆਲੂ ਛੋਲਿਆਂ ਦੀ ਸਬਜ਼ੀ ਬਹੁਤ ਵਧੀਆ ਲੱਗਦੀ ਹੈ ਅਤੇ ਮੈਂ ਇਹ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਰਾਤ ਨੂੰ ਪਹਿਲਾਂ ਛੋਲੇ ਭਿਓਂ ਕੇ ਰੱਖ ਦਿਓ ਅਤੇ ਸੁਬਹਾ ਉਹ ਪੋਲੇ ਹੋ ਜਾਣਗੇ ਕਿਉਂਕਿ ਫਿਰ ਉਹਨਾਂ ਨੂੰ ਪੱਕਣ 'ਚ ਕੋਈ ਜ਼ਿਆਦਾ ਦਿੱਕਤ ਨਹੀਂ ਆਏਗੀ ਫਿਰ ਕੀ ਕਰਨਾ ਆਪਾਂ ਆਲੂ ਕੱਟ ਲੈਣੇ ਆ ਨਾਲ ਅਤੇ ਇੱਕ ਮਸਾਲਾ ਤਿਆਰ ਕਰ ਲੈਣਾ ਹੈ ਗੰਢੇ ਲੈ ਲੈਣੇ ਆ ਥੋੜ੍ਹੇ ਜਿਹੇ ਦੋ ਤਿੰਨ ਗੰਢੇ ਲੈ ਲਏ ਇੱਕ ਦੋ ਟਮਾਟਰ ਲੈ ਲਏ ਥੋੜ੍ਹੀ ਜਿਹੀ ਹਰੀ ਮਿਰਚ ਲੈ ਲਈ ਲਸਣ ਲੈ ਲਈ ਅਦਰਕ ਲੈ ਲਿਆ ਇਹਨਾਂ ਸਾਰਿਆਂ ਨੂੰ ਬਰੀਕ ਬਰੀਕ ਕੱਟ ਕੇ ਕੁੰਡੇ ਵਿੱਚ ਕੁੱਟ ਲਓ ਭਾਵੇਂ ਮੈਕਸੀ ਵਿੱਚ ਕਰ ਲਓ ਉਹ ਆਪਣੀ ਮਰਜ਼ੀ ਆ ਫਿਰ ਬਾਅਦ 'ਚ ਕੀ ਕਰਨਾ ਕੂਕਰ ਜਾਂ ਕੜਾਹੀ ਜਾਂ ਪਤੀਲੀ ਲੈ ਲੈਣੀ ਹੈ ਉਸ ਵਿੱਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਪਾਉਣਾ ਹੈ ਅਤੇ ਉਸ ਵਿੱਚ ਆਪਣਾ ਜੋ ਤੜਕਾ ਹੈ ਉਸ ਨੂੰ ਪਾ ਦੇਣਾ ਹੈ ਜਿੰਨਾ ਟਾਈਮ ਉਹ ਬਰਾਊਨ ਨਹੀਂ ਹੋ ਜਾਂਦਾ ਭੂਰਾ ਨਹੀਂ ਹੋ ਜਾਂਦਾ ਉਨਾ ਟਾਈਮ ਆਪਾਂ ਉਹਨੂੰ ਪੱਕਣ ਦੇਣਾ ਫਿਰ ਉਹਦੇ ਵਿੱਚ ਧਨੀਆ ਪਾਊਡਰ ਪਾ ਦੇਣਾ ਨਮਕ ਪਾ ਦੇਣਾ ਮਿਰਚਾਂ ਪਾ ਦੇਣੀਆਂ ਹਲਦੀ ਪਾ ਦੇਣੀ ਆ ਜਿੰਨਾ ਟਾਈਮ ਉਹ ਭੁੱਜਦਾ ਨਹੀਂ ਉਨਾ ਟਾਈਮ ਉਹਦੇ ਵਿੱਚ ਆਲੂ ਜਾਂ ਪਾਣੀ ਨਹੀਂ ਪਾਉਣਾ ਜਦੋਂ ਪੂਰੀ ਚੰਗੀ ਤਰ੍ਹਾਂ ਪੱਕ ਜਾਣ ਫਿਰ ਆਪਾਂ ਉਸ ਵਿੱਚ ਥੋੜ੍ਹਾ ਜਿਹਾ ਪਾਣੀ ਪਾਵਾਂਗੇ ਉਸ ਨੂੰ ਰਿੰਨਾਂਗੇ ਫਿਰ ਵਿੱਚ ਆਲੂ ਪਾਵਾਂਗੇ ਉਸ ਤੋਂ ਬਾਅਦ ਉਹਨੂੰ ਥੋੜ੍ਹਾ ਟਾਈਮ ਪੱਕਣ ਦੇਣਾ ਜਦੋਂ ਉਹ ਪੱਕ ਗਿਆ ਉਸ ਤੋਂ ਉੱਤੇ ਉਸ 'ਤੇ ਥੋੜ੍ਹੀ ਜਿਹੀ ਮੇਥੀ ਪਾ ਦੇਣੀ ਹੈ ਜੋ ਉਸ ਲਈ ਉਹਦੇ ਸਵਾਦ 'ਚ ਵੀ ਜ਼ਿਆਦਾ ਮਤਲਬ ਟੇਸਟ ਵੀ ਵਧੀਆ ਬਣੇਗਾ ਉਹਦੇ ਨਾਲ ਫਰੈਗਰੈਂਸ ਵੀ ਮਤਲਬ ਖੁਸ਼ਬੂ ਵੀ ਵਧੀਆ ਆਵੇਗੀ